ਪ੍ਰਧਾਨ ਢਾਬੇ ਤੋਂ ਬੋਲ ਰਹੇ ਹੋ ਜੀ ਮੈਂ ਨਾ ਤੁਹਾਡੇ ਤੋਂ ਔਰਡਰ ਕੀਤਾ ਸੀਗਾ ਜੀ ਜਿਹਦੇ ਵਿੱਚ ਸ਼ਾਹੀ ਪਨੀਰ ਦਾਲ ਮੱਖਣੀ ਅਤੇ ਨਾਨ ਸੀਗੇ ਅਤੇ ਉਹਨਾਂ ਨੂੰ ਨਾ ਆਸਵਾੜਾ ਪਿੰਡ ਤੁਸੀਂ ਡਿਲੀਵਰ ਕਰਨਾ ਏ ਜੀ ਅਤੇ ਰਿਸ਼ਤੇਦਾਰ ਆਏ ਹੋਏ ਆਂ ਜੀ ਬਾਰ੍ਹਾਂ ਵਜੇ ਤੱਕ ਪਹੁੰਚਾ ਦਿਓ ਅਤੇ ਪਹਿਲਾਂ ਮੈਂ ਤੁਹਾਨੂੰ ਔਰਡਰ ਦਿੱਤਾ ਸੀਗਾ ਜੀ ਜਿਹੜਾ ਉਹਦੇ ਵਿੱਚ ਆਪਾਂ ਨੇ ਮਟਰ ਪਨੀਰ ਕਰਿਆ ਸੀਗਾ ਜੀ ਉਹਦੀ ਜਗ੍ਹਾ ਤੁਸੀਂ ਕੜਾਹੀ ਪਨੀਰ ਕਰ ਦਿਓ ਅਤੇ ਜਿਹੜੀਆਂ ਰੋਟੀਆਂ ਸੀਗੀਆਂ ਉਹਦੇ ਨਾਲ਼ ਰੁਮਾਲੀ ਰੋਟੀਆਂ ਐਡ ਕਰ ਦਿਓ ਹੋਰ ਜ਼ਿਆਦਾ ਅਤੇ ਇਹਨਾਂ ਨੂੰ ਜੀ ਇੱਕ ਵਜੇ ਤੋਂ ਪਹਿਲਾਂ ਮਤਲਬ ਪਹੁੰਚਾ ਦਿਓ ਘਰ ਰਿਸ਼ਤੇਦਾਰ ਆਏ ਹੋਏ ਨੇ